ਜੇ ਮੈਨੂੰ ਦੁਨੀਆਂ ਵਿੱਚ ਕਿਤੇ ਜਾਣ ਦਾ ਮੌਕਾ ਮਿਲੇ ਯਾਤਰਾ ਕਰਨ ਦਾ ਮੌਕਾ ਮਿਲੇ ਤਾਂ ਮੈਂ ਗੁਰਦੁਆਰਾ ਅੰਮ੍ਰਿਤਸਰ ਜੋ ਕਿ ਪੰਜਾਬ ਵਿੱਚ ਹੈ ਉੱਥੇ ਜਾਣਾ ਪਸੰਦ ਕਰਾਂਗੀ ਕਿਉਂਕਿ ਉੱਥੇ ਜਾ ਕੇ ਮੈਨੂੰ ਬਹੁਤ ਸਕੂਨ ਅਤੇ ਸ਼ਾਤੀ ਮਿਲਦੀ ਹੈ ਉੱਥੇ ਜਲ੍ਹਿਆਂਵਾਲਾ ਬਾਗ ਵੀ ਵੇਖਣਯੋਗ ਹੈ ਉੱਥੇ ਦੀਆਂ ਘਟਨਾਵਾਂ ਜੋ ਵੀ ਵਾਪਰੀਆਂ ਸਭ ਦਰਸਾਉਂਦੀਆਂ ਉੱਥੇ ਜਦੋਂ ਗੁਰਦੁਆਰੇ ਸਾਹਿਬ 'ਚ ਸਵੇਰੇ ਦੋ ਢਾਈ ਵਜੇ ਪਾਲਕੀ ਸਾਹਿਬ ਹੁੰਦੀ ਹੈ ਪਾਲਕੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਆਉਂਦੇ ਹੈ ਤਾਂ ਉਹ ਬਹੁਤ ਜ਼ਿਆਦਾ ਚੰਗਾ ਲੱਗਦਾ ਹੈ ਔਰ ਦੇਖਣਯੋਗ ਵੀ ਹੈ ਉਹ ਰਸਮ ਹੁੰਦੀ ਹੈ ਜੋ ਉਸ 'ਤੇ ਸਾਰੀ ਸੰਗਤ ਇਕੱਠੀ ਹੋ ਕੇ ਦਰਸ਼ਨਾਂ ਲਈ ਸੁਬਾਹ ਖੜ੍ਹਦੀ ਹੈ ਉਹਨਾਂ ਦੇ ਇੰਤਜ਼ਾਰ ਕਰਦੀ ਹੈ ਪਾਲਕੀ ਸਾਹਿਬ ਦਾ ਜਦੋਂ ਉੱਥੇ ਗੁਰਦੁਆਰੇ 'ਚ ਸੇਵਾ ਕਰਦੇ ਹਾਂ ਤਾਂ ਮਨ ਨੂੰ ਸਕੂਨ ਮਿਲਦਾ ਏ ਉੱਥੇ ਪੂ ਦਿਨ ਰਾਤ ਕੀਰਤਨ ਸਾਹਿਬ ਔਰ ਸ਼ਬਦ ਗਾਣ ਸਭ ਕੁਛ ਹੁੰਦਾ ਏ ਬਹੁਤ ਵਧੀਆ ਦੇਖਣ ਯੋਗ ਚੀਜ਼ ਹੈ ਉਹ